ਜੋ ਯਾਤਰਾ ਦਾ ਪ੍ਰੋਗਰਾਮ ਹੈ ਉਹ ਪਹਿਲਾਂ ਉਲੀਕਿਆ ਜਾਂਦਾ ਉਹਦੇ ਅਧਾਰ 'ਤੇ ਫਿਰ ਸਾਨੂੰ ਪੈਸੇ ਦਾ ਵੀ ਅਰੇਜਮੈਂਟ ਕਰਨਾ ਪੈਂਦਾ ਤਾਂ ਸਮੇਂ ਦੇ ਅਰੇਜਮੈਂਟ ਕਰਨਾ ਪੈਂਦਾ ਜਿਹੜਾ ਸਮਾਂ ਹੈ ਉਹ ਕਾਰੋਬਾਰ ਦਾ ਵੀ ਨਿਯੁਕਤ ਕਰਨਾ ਪੈਂਦਾ ਕਿ ਕਾਰੋਬਾਰ ਦੇ ਵਿੱਚ ਜਿਹੜਾ ਹੈ ਉਹਨੂੰ ਵੀ ਸੈਟ ਕਰਨਾ ਪੈਂਦਾ ਬੰਦੇ ਪਿੱਛੇ ਡਿਊਟੀਆਂ ਲਗਾਉਣੀਆਂ ਪੈਂਦੀਆਂ ਵੀ ਇਹ ਕੰਮ ਤੁਸੀਂ ਕਰਨੇ ਆ ਉਹਦੇ ਉਪਰੰਤ ਫਿਰ ਅਸੀਂ ਜਿਹੜਾ ਇੱਕ ਹਫ਼ਤਾ ਉਹ ਬੜੇ ਆਰਾਮ ਦੇ ਨਾਲ ਲਾ ਕੇ ਆਉਂਦੇ ਹੈ ਔਰ ਉਹਦੇ ਨਾਲ ਬਹੁਤ ਜਿਹੜਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਔਰ ਦੁਨੀਆਂ ਦਾ ਪਤਾ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਕਿਆ ਹੋ ਰਿਹਾ ਕਿੱਥੇ ਦੁਨੀਆਂ ਖੜ੍ਹੀ ਹੈ ਕਿੱਥੇ ਬਹੁਤ ਵੱਡੇ ਵੱਡੇ ਲੰਗਰ ਚੱਲ ਰਹੇ ਹੁੰਦੇ ਆ ਔਰ ਉਹ ਜਿਹੜੀਆਂ ਉੱਥੇ ਲੰਗਰਾਂ ਦੇ ਵਿੱਚ ਬਹੁਤ ਸੇਵਾ ਔਰ ਭਾਂਤ ਭਾਂਤ ਦੇ ਲੰਗਰ ਜਿਹੜੇ ਗੁਰੂ ਘਰ ਦੇ ਚੱਲਦੇ ਹੁੰਦੇ ਆ ਔਰ ਸੇਵਾ ਦਾ ਵੀ ਅੰਤ ਨਹੀਂ ਹੈ ਜਿਹੜੇ ਦਾਨੀ ਪੁਰਸ਼ ਹੈ ਉਹ ਵੀ ਬਹੁਤ ਦਾਨ ਕਰ ਰਹੇ ਹੈ ਜਿਨ੍ਹਾਂ ਦਾ ਉਹਨਾਂ ਲੰਗਰਾਂ ਦੇ ਵਿੱਚ ਬਹੁਤ ਵੱਡੇ ਯੋਗਦਾਨ ਹੈ ਮੇਵਿਆਂ ਦੇ ਵੀ ਲੰਗਰ ਲਗਾਏ ਜਾਂਦੇ ਹੈ ਕੇਸਰ ਦੇ ਦੁੱਧ ਦੇ ਲੰਗਰ ਲਗਾਏ ਜਾਂਦੇ ਹੈ ਔਰ ਜਿਹੜੀ ਹਿੰਮਤ ਉਹ ਤੁਹਾਡੀ ਬਹੁਤ ਵੱਧ ਜਾਂਦੀ ਜਦੋਂ ਉੱਥੇ ਕਿਤੇ ਚਨਿਆਂ ਦੇ ਸੂਪ ਦਾ ਜਿਹੜਾ ਹੈ ਛੋਲਿਆਂ ਦਾ ਉਹ ਵੀ ਮਿਲਦਾ ਅਤੇ ਜਿਹੜਾ ਬਹੁਤ ਵਧੀਆ ਮਤਲਬ ਪ੍ਰਬੰਧਨ ਦੇ ਨਾਲ ਜਿਹੜਾ ਹੈ ਦਰਸ਼ਨ ਕੀਤੇ ਜਾਂਦੇ ਆ ਔਰ ਜਿਹੜੀ ਹਿੰਮਤ ਹੈ ਉਹ ਸਭ ਤੋਂ ਵੱਡੀ ਚੀਜ਼ ਹੈ ਹਿੰਮਤ ਕਦੇ ਬੰਦੇ ਨੂੰ ਨਹੀਂ ਹਾਰਨੀ ਚਾਹੀਦੀ ਔਰ ਸੰਘਰਸ਼ ਜਿਹੜੀ ਹੈ ਜ਼ਿੰਦਗੀ ਇੱਕ ਸੰਘਰਸ਼ ਹੈ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ ਔਰ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਇਹੋ ਜਿਹੇ ਮੌਕੇ ਮਿਲਦੇ ਕਿ ਤੁਸੀਂ ਬਾਹਰ ਜਾ ਕੇ ਘੁੰਮ ਕੇ ਦੁਨੀਆਂ ਦੇਖੋ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਬਹੁਤ ਉਦਾਸੀਆਂ ਲਗਾਈਆਂ ਗੁਰੂ ਨਾਨਕ ਸਾਹਿਬ ਨੇ ਵੀ ਘੁੰਮ ਘੁੰਮ ਕੇ ਦੁਨੀਆਂ ਦੇਖੀ ਅਤੇ ਸਾਨੂੰ ਵੀ ਉਪਦੇਸ਼ ਦਿੰਦੇ ਹੈ ਕਿ ਜਾ ਕੇ ਦੁਨੀਆਂ ਦੇ ਵਿੱਚ ਚੱਕਰ ਲਗਾਓ ਔਰ ਦੁਨੀਆਂ ਨੂੰ ਦੇਖੋ ਕੁਛ ਸਮਝਾਓ ਅਤੇ ਕੁਛ ਸਮਝੋ